ਮੈਂ ਪਿਛਲੇ ਦਿਨੀਂ ਆਪਣੀ ਜਗ੍ਹਾ ਦੀ ਰਜਿਸਟਰੀ ਕਰਵਾਈ ਹੈ ਮੈਂ ਬੜੀ ਮੁਸ਼ਕਲ ਨਾਲ ਆਪਣੇ ਸਾਰੇ ਦਸਤਾਵੇਜ਼ ਬੈਂਕ ਅਤੇ ਪਟਵਾਰਖਾਨੇ ਤੋਂ ਇਕੱਠੇ ਕੀਤੇ ਹਨ ਰਜਿਸਟਰੀ ਕਰਵਾਉਣ ਦਾ ਅਨੁਭਵ ਚੰਗਾ ਵੀ ਰਿਹਾ ਅਤੇ ਮਾੜਾ ਵੀ ਰਿਹਾ ਕਿਉਂਕਿ ਦੱਸੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਵੀ ਦਸਤਾਵੇਜ਼ ਮੈਨੂੰ ਇਕੱਠੇ ਕਰਨੇ ਪਏ ਜੋ ਕਿ ਬੜੇ ਮੁਸ਼ਕਿਲ ਢੰਗ ਨਾਲ਼ ਮੈਨੂੰ ਮਿਲੇ ਜਿਵੇਂ ਜਗ੍ਹਾ ਦੀ ਫਰਦ ਨਕਸ਼ਾ ਆਦਿ ਕਿਉਂਕਿ ਮੇਰੀ ਇਹ ਜਗ੍ਹਾ ਬਹੁਤ ਪੁਰਾਣੀ ਸੀ ਜਿਸ ਦੇ ਦਸਤਾਵੇਜ਼ ਇਕੱਠਾ ਕਰਨ ਵਿੱਚ ਮੈਨੂੰ ਬਹੁਤ ਮੁਸ਼ਕਿਲ ਆਈ